ਰੂਪਨਗਰ ਜ਼ਿਲ੍ਹੇ ਵਿੱਚ ਰੋਜ਼ੀ ਰੋਟੀ ਦੇ ਮੁੱਖ ਸ੍ਰੋਤ ਥਰੈਸ਼ਰ ਲਾਈਨ ਹੈ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਰੂਪਨਗਰ ਜ਼ਿਲ੍ਹੇ ਦੇ ਨਾਲ ਸਤਲੁਜ ਦਰਿਆ ਲੱਗਦਾ ਹੈ ਜਿਸ ਵਿੱਚ ਰੇਤਾ ਬਜਰੀ ਗਟਕਾ ਬਹੁਤ ਬੜੀ ਮਾਤਰਾ ਵਿਚ ਪਾਈ ਜਾਂਦੀ ਹੈ ਇੱਥੇ ਲੋਕ ਜ਼ਿਆਦਾਤਰ ਇਸ ਰੁਜ਼ਗਾਰ 'ਤੇ ਹੀ ਡਿਪੈਂਡ ਹਨ ਬਾਕੀ ਰਹੀ ਗੱਲ ਸਰਕਾਰੀ ਨੌਕਰੀਆਂ ਜਾਂ ਨਿੱਜੀ ਨੌਕਰੀਆਂ ਸਰਕਾਰੀ ਨੌਕਰੀਆਂ ਅਤੇ ਨਿੱਜੀ ਨੌਕਰੀਆਂ ਨੂੰ ਤਰਜੀਹ ਇਸ ਕਰਕੇ ਦਿੰਦੇ ਹਨ ਕਿ ਰੋਪੜ ਦੇ ਨਾਲ ਚੰਡੀਗੜ੍ਹ ਮੋਹਾਲੀ ਜ਼ਿਲ੍ਹਾ ਲੱਗਦਾ ਹੈ ਜਿੱਥੇ ਕਿ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ ਬਹੁਤ ਹਨ ਸਾਡੇ ਜ਼ਿਲ੍ਹੇ ਤੋਂ ਪੱਚੀ ਜਾਂ ਤੀਹ ਮਿੰਟ ਦੀ ਡ੍ਰਾਈਵ ਮੋਹਾਲੀ ਚੰਡੀਗੜ੍ਹ ਦੀ ਹੈ ਜਿੱਥੇ ਆਉਣਾ ਜਾਣਾ ਬਹੁਤ ਸੁਖਾਲਾ ਹੈ ਬੱਸ ਸਰਵਿਸ ਵੀ ਬਹੁਤ ਵਧੀਆ ਹੈ ਇਸ ਲਈ ਇੱਥੇ ਲੋਕ ਸਰਕਾਰੀ ਨੌਕਰੀ ਅਤੇ ਨਿੱਜੀ ਨੌਕਰੀਆਂ ਨੂੰ ਬਹੁਤ ਤਰਜੀਹ ਦਿੰਦੇ ਹਨ ਸਾਡੇ ਜ਼ਿਲ੍ਹੇ ਵਿੱਚ ਬੇਰੁਜ਼ਗਾਰੀ ਵੀ ਬਹੁਤ ਹੈ ਜਿਵੇਂ ਮੈਂ ਦੇਖਿਆ ਅੱਜ ਕੱਲ੍ਹ ਬੱਚੇ ਡਿਗਰੀਆਂ ਡਿਪਲੋਮੇ ਕਰਕੇ ਵਿਹਲੇ ਬੈਠੇ ਹਨ ਤਾਂ ਮੈਂ ਸਰਕਾਰ ਨੂੰ ਦਰਖਾਸਤ ਕਰਦਾ ਹਾਂ ਕਿ ਜਿਹੜੇ ਵੀ ਬੱਚੇ ਨੇ ਜਿੱਦਾਂ ਦੀ ਡਿਗਰੀ ਜਿੱਦਾਂ ਦਾ ਡਿਪਲੋਮਾ ਜਾਂ ਜਿੱਦਾਂ ਦਾ ਦਾ ਵੀ ਕਿਸੇ ਦਾ ਤਜ਼ਰਬਾ ਹੈ ਤਜਰਬਾ ਹੈ ਤਜਰਬੇ ਨੂੰ ਦੇਖਦਿਆਂ ਦੇਖਦਿਆਂ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਮੇਰਾ ਇਹੀ ਸੁਝਾਅ ਹੈ